ਬਾਈ ਦਸੰਬਰ ਉੱਨੀ ਸੌ ਉਨਾਸੀ ਚੌਦਾਂ ਫ਼ਰਵਰੀ ਉੱਨੀ ਸੌ ਪਚਾਸੀ ਗਿਆਰਾਂ ਅਗਸਤ ਦੋ ਹਜ਼ਾਰ ਗਿਆਰਾਂ ਤੇਈ ਜੂਨ ਦੋ ਹਜ਼ਾਰ ਪੰਦਰਾਂ ਇੱਕ ਮਾਰਚ ਦੋ ਹਜਾਰ ਨੌ